ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਕਿਤਾਬ ਪੜ੍ਹੀ ਨਾਦ ਬਿੰਦ ਜੋਗਿੰਦਰ ਸਿੰਘ ਕੈਰੋਂ ਦਾ ਲਿਖਿਆ ਹੋਇਆ ਨਾਵਲ ਹੈ ਜਦੋਂ ਮੈਂ ਇਸ ਨਾਵਲ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰੇ ਵਿਚਾਰ ਹੋਰ ਸਨ ਮੈਂ ਇਸ ਸਮਾਜ ਵਿੱਚ ਰਹਿੰਦੇ ਹੋਏ ਇੱਕ ਪਰੰਪਰਕ ਜ਼ਿੰਦਗੀ ਨੂੰ ਨਾਵਲਾਂ ਰਾਹੀਂ ਵੇਖਣ ਦੀ ਕੋਸ਼ਿਸ਼ ਕਰਦਾ ਸੀ ਪਰ ਜਦੋਂ ਮੈਂ ਨਾਦ ਬਿੰਦ ਨਾਵਲ ਪੜ੍ਹਦਾਂ ਏ ਤਾਂ ਇਹਦੇ ਵਿੱਚ ਪਿਆਰ ਦੀ ਪਰਿਭਾਸ਼ਾ ਇੱਕ ਵੱਖਰੇ ਕਿਸਮ ਦੀ ਦਿੱਤੀ ਹੋਈ ਹੈ ਓਹਨਾ ਨੇ ਯਥਾਰਥ ਨੂੰ ਸਾਹਮਣੇ ਰੱਖਿਆ ਨਾਵਲ ਵਿੱਚ ਜਦੋਂ ਨਾਦ ਬਿੰਦ ਦੇ ਜਿਹੜੇ ਪਾਤਰ ਨੇ ਜਦੋਂ ਉਹ ਘਰੋਂ ਭੱਜ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਠਾਹਰ ਮਿਲਦੀ ਹੈ ਇੱਕ ਸੰਤ ਦੀ ਝੁੱਗੀ ਮਿਲਦੀ ਹੈ ਭੱਜੇ ਉਹ ਇਸ ਕਰਕੇ ਹਨ ਕਿ ਸ਼ਾਇਦ ਅਸੀਂ ਸਰੀਰਕ ਤੌਰ 'ਤੇ ਖੱਟੇ ਰਹਿ ਕੇ ਆਪਣੇ ਪਿਆਰ ਨੂੰ ਸਾਬਤ ਕਰ ਸਕਾਂਗੇ ਪਰ ਅਲਟੀਮੇਟਲੀ ਉਹ ਕੀ ਕਰਦੇ ਨੇ ਕਿ ਜ਼ਿੰਦਗੀ ਦੇ ਇਸ ਫਲਸਫੇ ਨੂੰ ਓਹ ਇਸ ਤਰ੍ਹਾਂ ਲੈਂਦੇ ਨੇ ਕਿ ਸ਼ਾਇਦ ਇਕੱਠੇ ਰਹਿਣਾ ਹੀ ਪਿਆਰ ਹੈ ਜਦੋਂ ਉਹ ਉਸ ਸੰਤ ਕੋਲ ਜਾਂਦੇ ਨੇ ਉਹ ਇੱਕ ਪੱਥਰ ਚੱਕਦਾ ਹੈ ਉਹਦੇ ਥੱਲੇ ਉਸ ਨੇ ਇਕ ਡੈਂਨ ਬਣਾਈ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਉਤਾਰ ਦਿੰਦਾ ਹੈ ਅਤੇ ਉਪਰੋਂ ਪੱਥਰ ਲਾ ਦਿੰਦਾ ਹੈ ਹੁਣ ਉਹ ਅੰਦਰ ਬੜੇ ਖੁਸ਼ ਨੇ ਕਿ ਅਸੀਂ ਦੋਨੋਂ ਇਕੱਠੇ ਹਾਂ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ ਪਹਿਲਾ ਦਿਨ ਉਹਨਾਂ ਦਾ ਬੜਾ ਇਕੱਠਿਆਂ ਦਾ ਪਿਆਰ ਵਿੱਚ ਗੁਜ਼ਰਦਾ ਹੈ ਉਹਨਾਂ ਲਈ ਇਹ ਪਿਆਰ ਹੈ ਉਹਨਾਂ ਦੇ ਸਰੀਰ 'ਤੇ ਕੋਈ ਕਪੜੇ ਨਹੀਂ ਹਨ ਉਹਨਾਂ ਲਈ ਇਹ ਪਿਆਰ ਹੈ ਉਹ ਜ਼ਿੰਦਗੀ ਦੀ ਭੋਗ ਵਸਤੂ ਨੂੰ ਪਿਆਰ ਸਮਝਦੇ ਹਨ ਪਰੰਤੂ ਜਦੋਂ ਸ਼ਾਮ ਨੂੰ ਉਹਨਾਂ ਨੂੰ ਕੁਝ ਨਹੀਂ ਮਿਲਦਾ ਖਾਣ ਨੂੰ ਤਾਂ ਇੱਕ ਦੂਜੇ ਤੋਂ ਚਿੜਨ ਲੱਗ ਜਾਂਦੇ ਹਨ ਸਾਰੀ ਰਾਤ ਇਸ ਤਰ੍ਹਾਂ ਲੰਘ ਜਾਂਦੀ ਹੈ ਅਤੇ ਉਹ ਫਿਰ ਭੋਗ ਨੂੰ ਹੀ ਪਿਆਰ ਸਮਝਦੇ ਹਨ ਪਰ ਅਗਲੇ ਦਿਨ ਭੁੱਖ ਉਨ੍ਹਾਂ ਨੂੰ ਇੰਨਾਂ ਕੁ ਜਲੀਲ ਕਰਦੀ ਹੈ ਭੁੱਖ ਉਨ੍ਹਾਂ ਨੂੰ ਇੰਨਾਂ ਕੁ ਤੰਗ ਕਰਦੀ ਹੈ ਕਿ ਉਹ ਇੱਕ ਦੂਜੇ ਨਾਲ ਲੜਦੇ ਹਨ ਇੱਕ ਦੂਜੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਲਈ ਉੱਥੇ ਪਿਆਰ ਸਿਰਫ ਭੁੱਖ ਹੋ ਜਾਂਦੀ ਹੈ ਫਿਰ ਉਹ ਇੱਕ ਦੂਜੇ ਨੂੰ ਖਾਣ ਲੱਗਜੇ ਹਨ ਜਾਂਦੇ ਹਨ ਇੱਕ ਦੂਜੇ ਨੂੰ ਦੰਦੀਆਂ ਵੱਢਦੇ ਹਨ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਖਾ ਜਾਂਦੇ ਹਨ ਜ਼ੋਰ ਵਾਲਾ ਮੁਰ ਮਰਦ ਔਰਤ ਨੂੰ ਖਾ ਜਾਂਦਾ ਹੈ ਉਹਦੀਆਂ ਹੱਡੀਆਂ ਉਹਦੇ ਸਾਹਮਣੇ ਹਨ ਉਹ ਸ਼ਾਇਦ ਉਹਦੇ ਵਿਚੋਂ ਹੁਣ ਉਹਨੂੰ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਜੋਗਿੰਦਰ ਸਿੰਘ ਪੈ ਕੈਰੋਂ ਦਾ ਇਹ ਨਾਵਲ ਇੱਕ ਵੱਖਰੀ ਕਿਸਮ ਦਾ ਨਾਵਲ ਹੈ ਜਿਹੜਾ ਮੇਰੀ ਸੋਚ ਨੂੰ ਮੇਰੀ ਸਮਝ ਨੂੰ ਮੇਰੀ ਸੰਸਕ੍ਰਿਤੀ ਨੂੰ ਇਸ ਸੰਸਕ੍ਰਿਤੀ ਵਿਚੋਂ ਸਮਝੇ ਹੋਏ ਪਿਆਰ ਨੂੰ ਹਲੂਣਦਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਪਿਆਰ ਇਸ ਸਮਾਜ ਵਿੱਚ ਰਹਿੰਦੇ ਹੋਏ ਸਿਰਫ ਇੱਕ ਦੂਜੇ ਨਾਲ ਰਹਿਣਾ ਨਹੀਂ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਵੇਖਣ ਲਈ ਇੱਕ ਦੂਜੇ ਨੂੰ ਸਮਝਣ ਲਈ ਦੂਰ ਰਹਿ ਕੇ ਵੀ ਪਿਆਰ ਕੀਤਾ ਜਾ ਸਕਦਾ ਹੈ ਜੇਕਰ ਸਮਾਜ ਵਿੱਚ ਰਹਿੰਦੇ ਹੋਏ ਤੁਹਾਡੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਸਮਾਜ ਦੇ ਨਾਲ ਤੁਸੀਂ ਖੜ੍ਹ ਕੇ ਬਾਹਰ ਟੱਕਰ ਨਹੀਂ ਲੈ ਸਕਦੇ ਤਾਂ ਤੁਹਾਨੂੰ ਲੁੱਕ ਕੇ ਵੀ ਜ਼ਿੰਦਗੀ ਜਿਊਣ ਦਾ ਕੋਈ ਹੱਕ ਨਹੀਂ ਇਸ ਕਰਕੇ ਇਹ ਚਾਹੀਦਾ ਹੈ ਕਿ ਤੁਸੀਂ ਬਾਹਰ ਖੜ੍ਹੇ ਹੋਵੋ ਲੋਕਾਂ ਦੇ ਨਾਲ ਟੱਕਰ ਲਓ ਸਮਾਜ ਨੂੰ ਨਾਲ ਲੈ ਕੇ ਚੱਲੋ ਕਾਨੂੰਨ ਨੂੰ ਨਾਲ ਲੈ ਕੇ ਚੱਲੋ ਕਾਨੂੰਨ ਜਦੋਂ ਤੁਹਾਡੇ ਹੱਕ ਵਿੱਚ ਹੋਵੇਗਾ ਸਮਾਜ ਨੂੰ ਕਾਨੂੰਨ ਤੁਹਾਡੇ ਵੱਲ ਤੁਰਨ ਲਈ ਪ੍ਰੇਰਿਤ ਕਰੇਗਾ ਕਾਨੂੰਨ ਤੁਹਾਨੂੰ ਹੱਕ ਦੇਵੇਗਾ ਇਹ ਹੱਕ ਹੀ ਤੁਹਾਨੂੰ ਸਮਾਜ ਦੇ ਸਾਹਮਣੇ ਖੜ੍ਹਾ ਕਰ ਸਕਣਗੇ ਸੋ ਜਦੋਂ ਉਹ ਹੱਡੀਆਂ ਦੇਖਦੇ ਨੇ ਇੱਕ ਦੂਜੇ ਦੀਆਂ ਖਾਧੀਆਂ ਹੋਈਆਂ ਹੱਡੀਆਂ ਦੇਖਦੇ ਨੇ ਇੱਕ ਦੂਜੇ ਦੀਆਂ ਚਰੁੰਡੀਆਂ ਹੋਈਆਂ ਹੱਡੀਆਂ ਦੇਖਦੇ ਨੇ ਤਾਂ ਉੱਥੋਂ ਪਿਆਰ ਖ਼ਤਮ ਹੋ ਗਿਆ ਨਜ਼ਰ ਆਉਂਦਾ ਹੈ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਬੜੀਆਂ ਟੁੰਬਣ ਵਾਲੀਆਂ ਹਨ ਇਸ ਨੇ ਮੇਰੀ ਸੋਚ ਨੂੰ ਬਹੁਤ ਵੱਖਰੇ ਲੈਵਲ 'ਤੇ ਲੈ ਕੇ ਖੜ੍ਹਾ ਕੀਤਾ ਹੈ